ਮੇਰੀ ਪਹਿਲੀ ਵਾਰ ਗਾਉਣ ਦੀ ਰੁਚੀ ਆਪਣੇ ਮਾਤਾ ਪਿਤਾ ਨੂੰ ਵੇਖ ਕੇ ਉਹਨਾਂ ਦੀ ਗਾਉਣ ਵਾਲੀ ਕਲਾ ਤੋਂ ਮੈਨੂੰ ਮਿਲੀ ਹੈ ਅਤੇ ਮੈਨੂੰ ਇਹ ਰੁਚੀ ਈ ਦਾ ਆਪਣਾ ਪਤਾ ਜੋ ਲੱਗਿਆ ਉਹ ਤਿੰਨ ਸਾਲ ਦੀ ਉਮਰ 'ਚ ਤੋਂ ਹੀ ਲੱਗ ਗਿਆ ਸੀਗਾ ਜਦੋਂ ਮੈਂ ਆਪਣੇ ਮਾਤਾ ਪਿਤਾ ਦੇ ਨਾਲ ਅਤੇ ਆਪਣੇ ਸਕੂਲ ਦੇ ਸਟੇਜ 'ਤੇ ਗਾਉਣਾ ਸ਼ੁਰੂ ਕੀਤਾ